ਆਮ ਤੌਰ ਤੇ ਮੱਜਾਂ ਗਾਵਾਂ ਬਕਰੀਆਂ ਭੇਡਾਂ ਮੁਰਗੀਆਂ ਵਗੈਰਾ ਘਰ ਵਿੱਚ ਪਾਲੀਆਂ ਜਾਂਦੀਆਂ ਹਨ ਜਿਸ ਵਿੱਚ ਗਊਆਂ ਮੱਜਾਂ ਬਕਰੀਆਂ ਦਾ ਦੁੱਧ ਕਾਫੀ ਵਧੀਆ ਰੇਟ ਤੇ ਵਿਕ ਜਾਂਦਾ ਹੈ ਤੇ ਇਸ ਦੀ ਸਾਨੂੰ ਕਾਫੀ ਆਮਦਨ ਹੁੰਦੀ ਹੈ ਇਸ ਤੋਂ ਤੇ ਭੇਡਾਂ ਭੇਡਾਂ ਤੋਂ ਸਾਨੂੰ ਉਨ ਮਿਲਦੀ ਹੈ ਜੋ ਕਿ ਵਧੀਆ ਰੇਟ ਵਿੱਚ ਵਿਕ ਜਾਂਦੀ ਹ ਤੇ ਮੁਰਗੀਆਂ ਤੋਂ ਵੀ ਸਾਨੂੰ ਆਮਦਨ ਹੁੰਦੀ ਆ ਅੰਡਿਆਂ ਵਗੈਰਾ ਤੋਂ